ਸਾਡੇ ਸਿੱਖਣ ਅਤੇ ਸਿੱਖਿਆ ਕਰਨ ਦੇ ਤਰੀਕੇ ਨੂੰ ਕਿਵੇਂ ਬਦਲ ਰਹੀ ਹੈ ਟੈਕਨੋਲੋਜੀ ਸਾਡੇ ਸਿੱਖਣ ਅਤੇ ਸਿੱਖਿਆ ਇਹ ਸਿੱਖਿਆ ਸਿੱਖਿਅਤ ਕਰਨ ਦੇ ਤਰੀਕੇ ਨੂੰ ਕਈ ਤਰੀਕਿਆਂ ਦੇ ਨਾਲ ਬਦਲ ਰਹੀ ਹੈ ਸਮਝਣ ਦਾ ਗਹਿਰਾ ਗਹਿਰਾ ਕਰਨ ਵਿੱਚ ਮਦਦ ਕਰ ਰਹੀ ਹੈ ਓਨਲਾਈਨ ਜਿਵੇਂ ਟੂਲਸ ਵਗੈਰਾ ਨੇ ਇੰਟਰਟੈਕਟਿਵ ਸਮਗਰੀ ਸਮਗਰੀ ਅਤੇ ਵਿਦਿਆਰਥੀਆਂ ਨੂੰ ਕੀਮਤੀ ਅਤੇ ਜ਼ਿਆਦਾ ਮਤਲਬ ਡੂੰਘਾਈ ਨਾਲ ਸਮਝ ਆ ਜਾਂਦੀ ਹੈ

ਸਿੱਖਿਆ ਦੀ ਲਾਗਤ ਜਿਹੜੀ ਆ ਜਿਵੇਂ ਵਿਦੇਸ਼ੀ ਟਿਊਟਰ ਜਿਹੜੇ ਨੇ ਕਲਾਸਾਂ ਦੇ ਬਿਨਾਂ ਪੜ੍ਹਾਈਆਂ ਦੇ ਉੱਚੇ ਉੱਚੀਆਂ ਗੁਣਵੱਤਾ ਦੀਆਂ ਚੀਜ਼ਾਂ ਜਿਹੜੀਆਂ ਪ੍ਰਾਪਤ ਹੋ ਸਕਦੀਆਂ ਨੇ ਅਤੇ ਸਕੂਲ ਦੇ ਯੂਨੀਵਰਸਿਟੀਆਂ ਦੇ ਵਿੱਚ ਸੜਕਾਂ ਸਬਕਾ ਦੀ ਵਰਤੋਂ ਦਾ ਨਵਾਂ ਰੂਪ ਕੀਤਾ ਗਿਆ ਓਨਲਾਈਨ ਫੋਰਮਿੰਗ ਟੀਚਿੰਗ ਐਪਲੀਕੇਸ਼ਨ ਵਗੈਰਾ ਪਲੇਟਫਾਰਮਸ ਵਿਦਿਆਰਥੀ ਆਪਣੇ ਆਪ ਨੂੰ ਜ਼ਿਆਦਾ ਐਕਟਿਵ ਉਹ ਐਕਟਿਵ ਬਣਾਉਂਦੇ ਨੇ ਅਤੇ ਇਹਦੇ ਨਾਲ ਸਵਾਲਾਂ ਨੂੰ ਸਾਡੇ ਇੱਕ ਦੂਜਿਆਂ ਦੇ ਨਾਲ ਸਾਂਝਾ ਕਰਦੇ ਨੇ ਵਿਦਿਆਰਥੀ ਜਿਹੜੇ ਆ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਅਤੇ ਸਮਝਣ ਦੇ ਵਿੱਚ ਵੀ ਸੁਧਾਰ ਆ ਸਕਦਾ ਹੈ